ਹੈਲੋ ਨਮਸਤੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਤੋਂ ਬੋਲਦੇ ਹੋ ਹਾਂਜੀ ਮੈਂ ਨਾ ਮੈਂ ਲੰਡਨ ਤੋਂ ਬੋਲ ਰਿਹਾ ਜੀ ਮੈਂ ਪੰਜਾਬ ਘੁੰਮਣ ਆਉਣਾ ਚਾਹੁੰਦਾ ਆਪਣੀ ਫੈਮਲੀ ਨਾਲ ਹਾਂਜੀ ਉਰੇ ਕੋਈ ਟੂਰਿਸਟ ਪਲੇਸ ਹੈਗੇ ਫੇਮਸ ਕੋਈ ਇਤਿਹਾਸਿਕ ਜਗ੍ਹਾ ਜਿਹੜੀ ਘੁੰਮਣਾਂ ਮੈਂ ਹਾਂਜੀ ਹਾਂਜੀ ਅਸੀਂ ਹੁਣ ਆਉਣਾ ਤਾਂ ਹੀ ਤੁਹਾਨੂੰ ਫੋਨ ਕੀਤਾ ਸੀਗਾ ਜੀ ਅਸੀਂ ਪਰਸੋਂ ਤੱਕ ਆਏਗੇ ਹਾਂਜੀ ਅਤੇ ਮੇਰੀ ਵਾਈਫ ਨੂੰ ਪੰਜਾਬੀ ਜੁੱਤੀ ਪਾਉਣ ਦਾ ਬਹੁਤ ਸ਼ੌਂਕ ਆ ਹਾਂਜੀ ਅੱਛਾ ਜੀ ਹੋਰ ਹੋਰ ਕੋਈ ਚੀਜ਼ ਜਿਹੜੀ ਵਧੀਆ ਹੁੰਦੀ ਹੋਵੇ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ

ਇਹ ਕਿੱਥੇ ਹੈ ਜੀ ਮਤਲਬ ਮੌਲ ਵਗੈਰਾ ਜਿਹੜੇ ਤੁਸੀਂ ਕਹਿ ਰਹੇ ਹੋ ਦੁਖ ਨਿਵਾਰਨ ਇਹ ਕਿੱਥੇ ਜਾ ਕੇ ਜੀ ਠੀਕ ਹੈ ਅਤੇ ਹਰੀ ਮ ਹਾਂਜੀ ਠੀਕ ਹੈ ਜੀ ਅਤੇ ਪੰਜਾਬੀ ਜੁੱਤੀ ਵੀ ਪਟਿਆਲੇ ਮਿਲ ਜੇਗੀ ਜੀ ਹਾਂਜੀ ਕੋਈ ਨਾ ਉਹ ਤਾਂ ਜੀ ਆਏਗੇ ਦੇਖ ਪਸੰਦ ਆਈ ਜਾਏਗੇ ਪੰਜਾਬੀ ਕਲਚਰ ਦਾ ਬਹੁਤ ਸੁਣਿਆ ਅੱਛਾ ਜੀ ਠੀਕ ਹੈ ਜੀ ਚਲੋ ਅਸੀਂ ਤੁਹਾਨੂੰ ਆ ਕੇ ਫੋਨ ਕਰਾਂਗੇ ਜੀ ਥੈਂਕ ਯੂ ਜੀ ਮੇਰਾ ਨਾਮ ਜੀ ਦਲਵੀਰ ਹੈ ਜੀ